ਜਦੋਂ ਮੇਰੇ ਕੋਲ ਸਮਾਂ ਘੱਟ ਹੁੰਦਾ ਹੈ ਤਾਂ ਮੈਂ ਮੈਗੀ ਬਣਾਉਂਦੀ ਹਨ ਮੈਨੂੰ ਮੈਗੀ ਬਹੁਤ ਜ਼ਿਆਦਾ ਹੀ ਪਸੰਦ ਹੈ ਇਸ ਕਰਕੇ ਮੈਂ ਮੈਗੀ ਬਣਾਉਣਾ ਜ਼ਿਆਦਾ ਪਸੰਦ ਕਰਦੀ ਹਾਂ ਮੈਗੀ ਮੈਗੀ ਬ ਬਣਾਉਣ ਲਈ ਸਭ ਤੋਂ ਪਹਿਲਾਂ ਮੈਂ ਪੈਨ ਵਿੱਚ ਓਇਲ ਡਾਲਦੀ ਹਾਂ ਜਿਸ ਕਰਕੇ ਜੇ ਉਹ ਗਰਮ ਹੋਣ ਤੋਂ ਬਾਅਦ ਉਹਨਾਂ ਵਿੱਚ ਪਿਆਜ਼ ਮਿਰਚ ਨੂੰ ਡਾਲ ਕੇ ਥੋੜ੍ਹਾ ਲਾਲ ਹੋਣ ਵਿੱਚ ਹੋਣ ਲਈ ਛੱਡ ਦਿੰਦੀ ਹਾਂ ਜੇਸੇ ਹੀ ਮੈਂ ਪਿਆਜ਼ ਭੁੰਨ ਜਾਂਦਾ ਹੈ ਤਾਂ ਮੈਂ ਉਹਦੇ ਵਿੱਚ ਥੋੜ੍ਹਾ ਪਾਣੀ ਡਾਲ ਕੇ ਉਹਨੂੰ ਵੋਇਲ ਕਰਦੀ ਹਾਂ ਅਤੇ ਜਦ ਉਹ ਵੋਇਲ ਹੋ ਜਾਂਦਾ ਤਾਂ ਉਹਦਾ ਵਿੱਚ ਮੈਗੀ ਪਾ ਕੇ ਉਹਦੇ ਮੈਗੀ ਮਸਾਲਾ ਪੋਕਿਟ ਵਿੱਚ ਮਿਲਦਾ ਹੈ ਅਤੇ ਉਹ ਪਾ ਕੇ ਉਹਨੂੰ ਪੱਕਣ ਲਈ ਛੱਡ ਦਿੰਦੇ ਹਨ ਜਦ ਇਹ ਪੰਜ ਛੇ ਮਿੰਨਟ ਬਾਅਦ ਮੇਰੀ ਮੈਗੀ ਬਣ ਜਾਂਦੀ ਹੈ ਤਾਂ ਉਹਨੂੰ ਮੈਂ ਅੱਛੀ ਤਰ੍ਹਾਂ ਗਾਰਸ਼ਿੰਗ ਕਰ ਕੇ ਉਹਦੇ ਵਿੱਚ ਧਨੀਆ ਪੱਤੇ ਡਾਲ ਕੇ ਚੰਗੀ ਤਰ੍ਹਾਂ ਅੱਛੀ ਤਰ੍ਹਾਂ ਉਹਨੂੰ ਥੋੜ੍ਹਾ ਸੈੱਟ ਕਰ ਦਿੰਦੀ ਹਾਂ ਉਸਦੇ ਬਾਅਦ ਉਹਨਾਂ ਨੂੰ ਮੈਂ ਖਾ ਲੈਂਦੀ ਹਾਂ